ਅਖਬਾਰਾਂ ਅਤੇ ਮੈਗਜ਼ਨਾਂ ਦੀਆਂ ਖ਼ਬਰਾਂ ਵਧੀਆ ਹੁੰਦੀਆਂ ਹਨ ਉਹਨਾਂ ਨੂੰ ਉਹ ਭਰੋਸੇਮੰਦ ਹੁੰਦੀਆਂ ਹਨ ਉਹਨਾਂ ਦੀ ਸ਼ਾਨਬੀਨ ਕਰਕੇ ਛਾਪਿਆ ਜਾਂਦਾ ਹੈ ਅਤੇ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਭਰੋਸੇਯੋਗ ਨਹੀਂ ਹੁੰਦੀਆਂ ਉਹ ਆਪਣੇ ਵਿਊ ਲੈਣ ਲਈ ਝੂਠੀਆਂ ਮੂਠੀਆਂ ਖ਼ਬਰਾਂ ਝੂਠੀਆਂ ਮੂਠੀਆਂ ਖ਼ਬਰਾਂ ਛਾਪ ਦਿੰਦੇ ਹਨ ਇਸ ਕਰਕੇ ਇਸ ਕਰਕੇ ਸਾਨੂੰ ਇਸ ਇਸ ਕਰਕੇ ਸਾਨੂੰ ਅਖ਼ਬਾਰਾਂ ਅਤੇ ਮੈਗਜ਼ੀਨਾਂ ਦੀਆਂ ਖ਼ਬਰਾਂ ਪੜ੍ਹਨੀਆਂ ਵਧੀਆ ਲੱਗਦੀਆਂ ਹਨ ਉਹ ਖ਼ਬਰਾਂ ਸ਼ੁੱਧ ਅਤੇ ਸਪਸ਼ਟ ਖ਼ਬਰਾਂ ਹੁੰਦੀਆਂ ਹਨ